ਖੇਡ ਵਿੱਚ ਵਿਰਾਟ ਕੋਹਲੀ ਮੇਰਾ ਪਸੰਦੀਦਾ ਖਿਡਾਰੀ ਹੈ ਉਸਦਾ ਸੁਭਾਅ ਬਹੁਤ ਹੀ ਚੰਗਾ ਹੈ ਅਤੇ ਉਹ ਹਰ ਨਾਲ ਵਧੀਆ ਤਰੀਕੇ ਨਾਲ ਗੱਲ ਕਰਦਾ ਹੈ ਉਸ ਦੇ ਸੁਭਾਅ ਕਰਕੇ ਹੀ ਉਹ ਮੈਨੂੰ ਬਹੁਤ ਵਧੀਆ ਲੱਗਦਾ ਹੈ ਉਹ ਹਮੇਸ਼ਾ ਡੀਸੀਪੀਂਨ ਵਿੱਚ ਰਹਿੰਦਾ ਹੈ ਉਹ ਆਪਣੇ ਤੋਂ ਨੀਚੇ ਖਿਡਾਰੀਆਂ ਨੂੰ ਵੀ ਬਹੁਤ ਵਧੀਆ ਢੰਗ ਨਾਲ ਪ੍ਰੇਰਿਤ ਕਰਦਾ ਹੈ ਵਿਰਾਟ ਕੋਹਲੀ